ਹੈਲੋ ਹਾਂਜੀ ਕੌਣ

ਫੋਟੋਸ਼ੂਟ ਕਰਵਾਉਣਾ ਕਿਹਦਾ ਫੋਟੋਸ਼ੂਟ ਕਰਵਾਉਣਾ ਸਰ ਤੁਸੀਂ ਦੋ ਤਿੰਨ ਦਿਨ ਦਾ ਕਾਹਦਾ ਚਾਹੀਦਾ ਕਾਹਦਾ ਚਾਹੀਦਾ ਸਰ ਵਿਆਹ ਦਾ ਅੱਛਾ ਹੋਰ ਕੀ ਕੀ ਕਰਨਾ ਸਰ

ਅੱਛਾ ਸਰ ਅਤੇ ਦੋ ਤਿੰਨ ਦਿਨ ਦੇ ਵਿੱਚ ਵਿੱਚ ਚਾਹੀਦਾ ਸਰ ਦੋ ਤਿੰਨ ਦਿਨ ਵਿੱਚ ਵਿੱਚ ਪ੍ਰੀ ਪ੍ਰੀ ਵੈਡਿੰਗ ਵੀ ਕਰਵਾਉਣੀ ਆ ਸਰ ਕੋਈ ਨਹੀਂ ਸਰ ਉਹ ਹੋ ਜਾਏਗਾ ਤੁਸੀਂ ਟੈਂਸ਼ਨ ਨਾ ਲਓ ਅਸੀਂ ਇੱਕ ਦੋ ਦਿਨ ਵਿੱਚ ਆ ਜਾਂਦੇ ਹਾਂ ਅਤੇ ਅਸੀਂ ਹੋਣ ਵਾਲੇ ਦੂਲਾ ਦੁਲਹਨ ਨੂੰ ਲੈ ਜਾਂਗੇ ਸਾਡੀ ਆਪਣੀ ਜਗ੍ਹਾ 'ਤੇ ਉੱਥੇ ਅਸੀਂ ਆ ਕੇ ਆਪਣਾ ਪ੍ਰੀ ਵੈਡਿੰਗ ਕਰਵਾਵਾਂਗੇ ਸਰ ਆਪਣਾ ਖਰਚਾ ਲਗਭਗ ਡੇਢ ਕੁ ਲੱਖ ਦੇ ਕਰੀਬ ਆ ਜਾਏਗਾ ਉਹਦੇ 'ਚ ਤੁਹਾਡੀ ਪ੍ਰੀ ਵੈਡਿੰਗ ਵੀ ਆ ਜਾਏਗੀ ਉਹ 'ਚ ਤੁਹਾਡੀ ਵੈਡਿੰਗ ਵੀ ਆ ਜਾਏਗੀ ਉਹ 'ਚ ਤੁਹਾਡੀ ਰਿਸੈਪਸ਼ਨ ਵੀ ਆ ਜਾਏਗੀ ਫੋਟੋਆਂ ਅਤੇ ਵੀਡੀਓ ਦੋਵੇਂ ਜ਼ਿਆਦਾ ਨਹੀਂ ਸਰ ਦੇਖੋ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਆਪਾਂ ਪ੍ਰੀ ਵੈਡਿੰਗ ਵੀ ਕਰਨੀ ਹੈ ਸ਼ਾਮ ਨੂੰ ਮਹਿੰਦੀ ਉਹ ਜਿੰਨਾ ਵੀ ਤੇਲ ਵਗੈਰਾ ਇਸ ਤੋਂ ਬਾਅਦ ਵੈਡਿੰਗ ਉਸ ਤੋਂ ਬਾਅਦ ਤੁਹਾਡੀ ਰਿਸੈਪਸ਼ਨ ਉਹ ਸਾਰਾ ਦੇਖਾਂਗੇ ਆਪਾਂ ਅਤੇ ਤੁਹਾਨੂੰ ਫੋਟੋਆਂ ਦੇ ਨਾਲ ਨਾਲ ਐਲਬਮ ਵਧੀਆ ਬਣਾ ਕੇ ਦਵਾਂਗੇ ਜਿਹੜੀ ਪ੍ਰੀ ਵੈਡਿੰਗ ਦੀ ਆਪਣੀ ਥਾਂ ਹੋਏਗੀ ਉਹ ਅਸੀਂ ਖੁਦ ਲੈ ਕੇ ਜਾਵਾਂਗੇ ਸਾਡੇ ਜਿਹੜੇ ਜਿੰਨੇ ਜੋ ਵੀ ਤੁਹਾਡਾ ਬ੍ਰਦਰ ਤੁਹਾਡੀ ਸਿਸਟਰ ਨੂੰ ਜਿਹਨੂੰ ਵੀ ਹੈ ਅਸੀਂ ਖ਼ੁਦ ਲੈ ਕੇ ਜਾਵਾਂਗੇ ਆਪਣੇ ਖ਼ਰਚੇ 'ਤੇ ਨਹੀਂ ਨਹੀਂ ਸਰ ਲੱਖ ਰੁਪਇਆ ਤਾਂ ਬਹੁਤ ਘੱਟ ਹੋ ਜਾਣਾ ਸਰ ਸਵਾ ਕੁ ਲੱਖ ਚਲੋ ਕਰ ਲੈਂਦੇ ਆਪਾਂ ਕੋਈ ਨਹੀਂ ਮੈਂ ਬਾਕੀ ਆਪਾਂ ਕਰ ਲਾਂਗੇ ਉਹ ਦੀ ਟੈਂਸ਼ਨ ਨਾ ਲਓ ਤੁਸੀਂ ਜਿੰਨਾ ਹੋ ਚੁੱਕਿਆ ਉੱਨਾਂ ਮੈਂ ਘੱਟ ਕਰਾਂਗਾ ਜਿੰਨਾ ਤੁਸੀਂ ਵੀ ਹੋਰ ਕਰ ਸਕਦੇ ਹੋ ਉੱਨਾਂ ਤੁਸੀਂ ਵਧਾਇਓ ਠੀਕ ਹੈ ਬਾਕੀ ਕੋਈ ਗੱਲ ਨਹੀਂ ਤੁਸੀਂ ਮੈਂ ਤੁਹਾਡੇ ਕੋਲ ਕੁ ਅੱਜ ਸ਼ਾਮ ਜਾਂ ਕੱਲ੍ਹ ਸਵੇਰ ਤੱਕ ਆ ਜਾਂਦਾ ਆਪਾਂ ਬਹਿ ਕੇ ਸਾਰਾ ਕੁਛ ਗੱਲਬਾਤ ਕਰ ਲੈਂਦੇ ਹਾਂ ਕਿੱਦਾਂ ਫੋਟੋ ਕਰਵਾਉਣੀ ਹੈ ਕਿੱਦਾਂ ਫੋਹੋਸ਼ੂਟ ਅਤੇ ਕਦੋਂ ਲੈ ਕੇ ਜਾਣਾ ਪ੍ਰੀ ਵੈਡਿੰਗ ਕਦੋਂ ਕਰਵਾਉਣੀ ਹੈ ਸਰ ਠੀਕ ਹੈ ਹਾਂਜੀ ਹਾਂਜੀ ਹਾਂਜੀ ਸਰ ਬਣੀਆਂ ਹੋਈਆਂ ਆਪਣੇ ਕੋਲ ਸਾਰੀਆਂ ਬਣੀਆਂ ਹੋਈਆਂ ਪਹਿਲਾਂ ਹੀ ਤੁਸੀਂ ਕੋਈ ਗੱਲ ਨਹੀਂ ਮੈਂ ਕੱਲ੍ਹ ਆਉਂਦੇ ਹੋਏ ਲੈਂਦਾ ਵਾਂ ਮੈਂ ਨਾਲ ਹੀ ਮੈਂ ਪ੍ਰੀ ਵੈਡਿੰਗ ਦੀਆਂ ਵੀ ਲੈਂਦਾ ਆਵਾਂਗਾ ਮੈਂ ਮਹਿੰਦੀ ਜੋ ਵੀ ਜਿੰਨੀਆਂ ਵੀ ਅਸੀਂ ਰਸਮਾਂ ਕਰਵਾਈ ਦੀਆਂ ਆਪਣੇ ਹਿਸਾਬ ਨਾਲ ਵੈਡਿੰਗ ਦੀਆਂ ਅਤੇ ਰਿਸੈਪਸ਼ਨ ਦੀਆਂ ਸਾਰੀਆਂ ਮੈਂ ਇੱਕ ਵਾਰੀ ਇਗਜਾਮਪਲ ਚੁੱਕੀ ਲਿਆਵਾਂਗਾ ਅਤੇ ਕੋਈ ਨਹੀਂ ਸਰ ਮੈਂ ਕੱਲ੍ਹ ਆ ਜਾਵਾਂਗਾ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਓਕੇ ਓਕੇ